ਜਿਵੇਂ ਕਿ ਅਸੀਂ ਘਰਾਂ ਵਿੱਚ ਦੁੱਧ ਦੇ ਪ੍ਰਬੰਧ ਲਈ ਪਸ਼ੂ ਰੱਖੇ ਹੋਏ ਹਨ ਉਹਨਾਂ ਦੀ ਸਾਫ ਸਫਾਈ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਸਾਫ ਸਫਾਈ ਲਈ ਉਹਨਾਂ ਨੂੰ ਸਮੇਂ ਸਮੇਂ ਸਿਰ ਇੱਧਰ ਉੱਧਰ ਬੰਨ੍ਹਣਾ ਪੈਂਦਾ ਹੈ ਪਸ਼ੂਆਂ ਨੂੰ ਧੁੱਪਾਂ ਤੋਂ ਵੀ ਬਚਾਅ ਕੇ ਰੱਖਣਾ ਪੈਂਦਾ ਹੈ ਪਸ਼ੂਆਂ ਨੂੰ ਸ਼ੈੱਡ ਥੱਲੇ ਬੰਨ੍ਹਣਾ ਪੈਂਦਾ ਹੈ ਜੋ ਕਿ ਨਾਲ ਸਾਡੇ ਘਰ ਦੇ ਵੀ ਮਦਦ ਕਰਵਾ ਦਿੰਦੇ ਹਨ ਅਤੇ ਉਹਨਾਂ ਨੂੰ ਖਾਣ ਲਈ ਵੀ ਵਧੀਆ ਸਾਫ ਸੁਥਰਾ ਦਾਣਾ ਪਾਉਣਾ ਚਾਹੀਦਾ ਹੈ ਤਾਂ ਜੋ ਕਿ ਦੁੱਧ ਦੀ ਗੁਣਵੱਤਾ ਵਧੀਆ ਹੋਵੇ ਸਮੇਂ ਸਮੇਂ ਸਿਰ ਪਾਣੀ ਵੀ ਪਿਲਾਉਣਾ ਪੈਂਦਾ ਹੈ ਕਿਉਂਕਿ ਗਰਮੀ ਬਹੁਤ ਹੈ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਲਈ ਡਾਕਟਰ ਨੂੰ ਵੀ ਸਮੇਂ ਸਮੇਂ ਸਿਰ ਬੁਲਾਉਣਾ ਪੈਂਦਾ ਹੈ ਅਤੇ ਬਿਮਾਰੀਆਂ ਪਸ਼ੂਆਂ ਨੂੰ ਬਹੁਤ ਹੋ ਜਾਂਦੀਆਂ ਹਨ ਪਸ਼ੂਆਂ ਨੂੰ ਜ਼ਿਆਦਤਰ ਗਲਘੋਟੂਆ ਮੂੰਹਖੋਰ ਦੀ ਸਿੰਗਾ ਦੀਆਂ ਚਿੱਚੜਾਂ ਦੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਹਨ ਤਾਂ ਕਿ ਉਹਨਾਂ ਦੇ ਥੱਲੇ ਸਾਨੂੰ ਚੂਨਾ ਬਗੈਰਾ ਪਾ ਕੇ ਰੱਖਣਾ ਚਾਹੀਦਾ ਹੈ